ਬੱਚੇ ਪੰਛੀਆਂ ਨੂੰ ਦੇਖਣਾ ਬਹੁਤ ਪਸੰਦ ਕਰਦੇ ਹਨ ਤੇ ਇਸ ਨੂੰ ਦੇਖਣ ਲਈ ਬੱਚੇ ਵਧੇਰੀਆ ਹਰਕਤਾਂ ਤੇ ਬਥੇਰੇ ਤਰੀਕੇ ਅਪਣਾਉਂਦੇ ਹਨ ਘਰਾਂ ਵਿੱਚ ਜਾਂ ਪਿੰਡਾਂ ਵਿੱਚ ਲੋਕ ਆਪਣੇ ਬੱਚਿਆਂ ਨੂੰ ਇਹ ਖਾਣਾ ਖਵਾਉਣ ਤੋਂ ਬਾਅਦ ਤੇ ਉਸਨੂੰ ਖਡਾਉਣ ਲਈ ਵੇੜਿਆਂ ਵਿੱਚ ਛੱਡ ਦਿੰਦੇ ਹਨ ਤੇ ਉਹ ਬੱਚੇ ਕੁਝ ਨਾ ਕੁਝ ਪ੍ਰਕਿਰਿਆ ਕਰਦੇ ਰਹਿੰਦੇ ਹਨ ਉਹ ਵਧੇਰੇ ਤਰੀਕਿਆਂ ਨਾਲ ਪੰਛੀਆਂ ਨੂੰ ਉਚਾਰਦੇ ਹਨ ਜਿਵੇਂ ਕਿ ਉਹ ਪੰਛੀਆਂ ਨੂੰ ਚਾਰਾਂ ਪਾਉਂਦੇ ਚਾਰਾ ਪਾ ਪਾ ਕੇ ਬੁਲਾਉਂਦੇ ਹਨ ਜਾਂ ਫਿਰ ਉਹਨਾਂ ਦੀਆਂ ਛੋਟੇ ਛੋਟੇ ਘੋਸਲੇ ਬਣਾਉਂਦੇ ਹਨ ਜਿਹਦੇ ਨਾਲ ਉਹ ਆਪਣੇ ਵੱਖਰੇ ਵੱਖਰੇ ਤਰੀਕਿਆਂ ਨਾਲ ਉਸ ਨੂੰ ਉਚਾਰਦੇ ਹਨ ਕੀ ਪੰਛੀ ਤੁਹਾਡੇ ਤੋਂ ਉਪਯੁਕਤ ਹੋ ਕੇ ਤੁਹਾਡੇ ਕੋਲ ਨੀਚੇ ਆ ਕੇ ਚਾਰਾ ਖਾਣ ਇਸ ਲਈ ਪੰਛੀ ਨੂੰ ਉਚਾਰਨ ਵਾਸਤੇ ਕੁਝ ਬੱਚੇ ਤਾਂ ਉਸ ਨੂੰ ਡੰਡੇ ਤੀਲੀ ਨਾਲ ਵੀ ਬੁਲਾਉਂਦੇ ਹਨ ਉਹ ਬੱਚੇ ਉਹਨਾਂ ਨੂੰ ਅਲੱਗ ਅਲੱਗ ਤਰੀਕਿਆਂ ਨਾਲ ਉਚਾਰਦੇ ਹਨ ਜਿਵੇਂ ਕਿ ਉਹ ਬ ਚਾਰਾ ਪਾਉਂਦੇ ਹਨ ਜਾਂ ਫਿਰ ਉਹਨਾਂ ਦੇ ਘੋਸਲੇ ਬਣਾਉਂਦੇ ਹਨ ਉਹਨਾਂ ਨੂੰ ਪਾਣੀ ਪਿਲਾਉਂਦੇ ਹਨ ਬਾਟੇ ਵਿੱਚ ਜਿਸ ਨਾਲ ਉਹ ਨੀਚੇ ਆ ਜਾਂਦੇ ਹਨ